ਲੋਕਡਾਊਨ ਵਿੱਚ ਮੈਂ ਬਹੁਤ ਸਾਰੀਆਂ ਚੀਜ਼ਾਂ ਘਰ ਪਕਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕਈ ਚੀਜ਼ਾਂ ਬਹੁਤ ਵਧੀਆ ਵੀ ਬਣੀਆਂ ਅਤੇ ਅਸੀਂ ਹੁਣ ਵੀ ਬਣਾ ਕੇ ਖਾਂਦੇ ਹਾਂ ਜਿੱਦਾਂ ਕਿ ਅਸੀਂ ਇੱਕ ਦਿਨ ਪਕੌੜੇ ਬਣਾਏ ਸੀ ਜੋ ਕਿ ਬਹੁਤ ਸਵਾਦ ਬਣੇ ਸੀ ਅਤੇ ਅਸੀਂ ਉਹਦੇ ਨਾਲ ਬਾਹਰ ਵਰਗੀ ਚਟਨੀ ਵੀ ਬਣਾਈ ਸੀ ਅਤੇ ਅਸੀਂ ਨਿਊਡਲਸ ਬਣਾਏ ਸੀਗੇ ਜੋ ਕਿ ਅਸੀਂ ਨਿਊਡਲਸ ਬਾਹਰੋਂ ਔਡਰ ਕਰ ਲਏ ਸੀਗੇ ਅਤੇ ਸਾਨੂੰ ਔਫਲਾਈਨ ਦੇ ਗਏ ਸੀ ਉਹ ਤਾਂ ਅਸੀਂ ਫਿਰ ਉਹਨਾਂ ਨੂੰ ਘਰ ਬਣਾਇਆ ਸੀਗਾ ਪੈਕਡ ਨਿਊਡਲਸ ਨੂੰ ਅਸੀਂ ਘਰ ਬਣਾ ਕੇ ਫਿਰ ਉਹ ਜਦੋਂ ਅਸੀਂ ਖਾਧੇ ਤਾਂ ਸਾਨੂੰ ਬਾਹਰ ਦੇ ਟੇਸਟ ਨਾਲੋਂ ਵੀ ਜ਼ਿਆਦਾ ਟੇਸਟੀ ਲੱਗੇ ਅਸੀਂ ਘਰ ਦੇ ਵਿੱਚ ਪਾਓ ਭਾਜੀ ਵੀ ਬਣਾਈ ਸੀ ਜੋ ਕਿ ਬਹੁਤ ਹੀ ਜ਼ਿਆਦਾ ਸਵਾਦ ਬਣੀ ਸੀ ਅਤੇ ਹੁਣ ਅਸੀਂ ਬਾਹਰ ਦੀ ਪਾਓ ਭਾਜੀ ਖਾਣਾ ਪਸੰਦ ਵੀ ਨਹੀਂ ਕਰਦੇ ਅਸੀਂ ਘਰ ਵਿੱਚ ਪੀਜ਼ਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਸਹੀ ਨਹੀਂ ਸੀ ਬਣਿਆ ਕਿਉਂਕਿ ਸਾਡੇ ਕੋਲ ਓਵਨ ਨਹੀਂ ਸੀ ਅਸੀਂ ਘਰ ਦੇ ਵਿੱਚ ਹੋਰ ਵੀ ਕਈ ਚਾਈਨੀਜ਼ ਆਈਟਮਸ ਬਣਾਈਆਂ ਸੀ ਜਿੱਦਾਂ ਕਿ ਫਰੈਂਚ ਫ੍ਰਾਈਜ਼ ਵੀ ਬਣਾਏ ਸੀ ਜੋ ਕਿ ਬਹੁਤ ਸਵਾਦ ਬਣੇ ਸੀਗੇ ਪਰ ਬਾਹਰ ਵਰਗੇ ਨਹੀਂ ਬਣ ਸਕਦੇ ਕਿਉਂਕਿ ਬਾਹਰ ਵਾਲੇ ਪਤਾ ਨਹੀਂ ਕੀ ਪਾਉਂਦੇ ਹਨ ਜਿਹਦੇ ਨਾਲ ਉਹ ਜ਼ਿਆਦਾ ਸਵਾਦ ਲੱਗਦੇ ਹਨ ਅਸੀਂ ਘਰ ਵਿੱਚ ਮਨਚੂਰੀਅਨ ਬਣਾਇਆ ਸੀਗਾ ਜੋ ਕਿ ਬਹੁਤ ਸਵਾਦ ਬਣਿਆ ਸੀ ਕਿਉਂਕਿ ਸਾਡੇ ਸ਼ਹਿਰ ਵਿੱਚ ਮਨਚੂਰੀਅਨ ਜ਼ਿਆਦਾ ਸਵਾਦ ਨਹੀਂ ਮਿਲਦਾ ਕਿਤੋਂ ਅਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਸਨ ਜਿੱਦਾਂ ਕਿ ਟਿੱਕੀ ਗੋਲਗੱਪੇ ਵਗੈਰਾ ਜੋ ਕਿ ਇੰਨੇ ਵਧੀਆ ਨਹੀਂ ਬਣੇ ਪਰ ਖਾਣ ਯੋਗ ਸੀਗੇ ਅਸੀਂ ਵਾਹਵਾ ਸਾਰੀਆਂ ਚੀਜ਼ਾਂ ਬਣਉਂਦੇ ਹਾਂ ਹੁਣ ਵੀ ਅਸੀਂ ਲੋਕਡਾਊਨ ਵਾਲੀਆਂ ਚੀਜ਼ਾਂ ਨੂੰ ਦੁਹਰਾਉਂਦੇ ਹਾਂ ਕਿਉਂਕਿ ਕਈ ਚੀਜ਼ਾਂ ਬਹੁਤ ਹੀ ਜ਼ਿਆਦਾ ਸਵਾਦ ਸੀਗੀਆਂ ਅਤੇ ਕੁਛ ਜਿਹੜੀਆਂ ਨਹੀਂ ਬਣੀਆਂ ਉਹਨਾਂ ਨੂੰ ਫਿਰ ਅਸੀਂ ਨਹੀਂ ਬਣਾਇਆ ਬਾਅਦ 'ਚੋਂ ਵੀ